ਪੰਜਾਬੀ ਸੱਭਿਆਚਾਰ ਦੇ ਵਿੱਚ ਭੰਗੜੇ ਦੀ ਹੀ ਸਭ ਤੋਂ ਵੱਧ ਮਹੱਤਤਾ ਹੈ ਕਿਉਂਕਿ ਭੰਗੜੇ ਬਿਨਾਂ ਕੋਈ ਪੰਜਾਬੀ ਸੱਭਿਆਚਾਰ ਜੱਚਦਾ ਹੀ ਨਹੀਂ ਇਸ ਕਰਕੇ ਪੰਜਾਬ ਵਿੱਚ ਭੰਗੜਾ ਬਹੁਤ ਮਸ਼ਹੂਰ ਹੈ ਇਹਦੀ ਬਹੁਤ ਮਹੱਤਤਾ ਹੈ ਜਿੱਥੇ ਪਤਾ ਲੱਗ ਜੇ ਕਿ ਭੰਗੜਾ ਆ ਗਿਆ ਤਾਂ ਸਾਰੇ ਜ ਕੋਈ ਬੈਠੇ ਹੋਏ ਸਰੋਤੇ ਵੀ ਟਿਕ ਕੇ ਬਹਿ ਜਾਂਦੇ ਕਿ ਹਾਂ ਹੁਣ ਆਪਾਂ ਭੰਗੜਾ ਦੇਖਾਂਗੇ ਅਤੇ ਸਮੇਂ ਦੇ ਨਾਲ ਨਾਲ ਪੰਜਾਬ ਦੇ ਤਿਉਹਾਰਾਂ 'ਚ ਇਸ ਦਾ ਬਹੁਤ ਮਹੱਤਵ ਵਧਿਆ ਕਿਉਂਕਿ ਪਹਿਲਾਂ ਲੋਕ ਭੰਗੜਾ ਕਰਦੇ ਸੀ ਫਿਰ ਵਿੱਚ ਕੀ ਹੋ ਗਿਆ ਬੱਚੇ ਇਹਨਾਂ ਵੱਲ ਧਿਆਨ ਦੇਣੋ ਘੱਟ ਗਏ ਭੰਗ ਜੇ ਅਸੀਂ ਤਿਉਹਾਰਾਂ ਦੇ ਵਿੱਚ ਭੰਗੜਾ ਬਿਲਕੁਲ ਨਾਲ ਅਟੈਚ ਕਰਦੇ ਹਾਂ ਤਾਂ ਬੱਚੇ ਉਹਦੇ ਵੱਲ ਧਿਆਨ ਦੇਣਗੇ ਅੱਜ ਕੱਲ੍ਹ ਦੀ ਜਨਰੇਸ਼ਨ ਉਹਦੇ ਵੱਲ ਧਿਆਨ ਦਵੇਗੀ ਅਤੇ ਉਹ ਫੋਨਾ ਤੋਂ ਸੋਸ਼ਲ ਮੀਡੀਆ ਫਾਲਤੂ ਦੀਆਂ ਕੰਮਾਂ ਤੋਂ ਦੂਰ ਹਟੇਗੀ ਜਦੋਂ ਭੰਗੜਾ ਕਰੇਗੀ ਤਾਂ ਆਟੋਮੈਟਿਕਲੀ ਉਹ ਸ ਖੁਸ਼ ਵੀ ਰਹਿਣਗੇ ਅਤੇ ਫਿੱਟ ਵੀ ਰਹਿਣਗੇ ਕਿਉਂਕਿ ਭੰਗੜੇ ਨਾਲ ਜਿਵੇਂ ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਐਕਸਰਸਾਈਜ਼ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਬੱਚੇ ਦਾ ਸ਼ੌਂਕ ਵੱਧਦਾ ਹੈ ਅਤੇ ਭੰਗੜਾ ਅੱਜ ਕੱਲ੍ਹ ਪੂਰੇ ਸਿਖਰਾਂ 'ਤੇ ਜਾ ਰਿਹਾ ਪੰਜਾਬ ਦਾ